ਮੈਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਮੈਂ ਇੱਕ ਮੈਂ ਜਿਹੜ ਬੁ ਇੱਕ ਕਿਤਾਬ ਮੈਂ ਨਰਿੰਦਰ ਕਪੂਰ ਦੀ ਪੜ੍ਹੀ ਖਿੜਕੀਆਂ ਇਸ ਕਿਤਾਬ ਦਾ ਨਾਮ ਖਿੜਕੀਆਂ ਸੀ ਇਸ ਕਿਤਾਬ ਨੇ ਮੈਨੂੰ ਬੋ ਬੋਧਿਕ ਤੌਰ 'ਤੇ ਚੁਣੌਤੀ ਦਿੱਤੀ ਹੈ ਇਸ ਕਿਤਾਬ ਵਿੱਚ ਇੱਕ ਬੱਸ ਵਿੱਚ ਅਮੀਰ ਅਤੇ ਗਰੀਬ ਲੋਕ ਬੈਠੇ ਹੋਏ ਸਨ ਉਸ ਵਿੱਚ ਇੱਕ ਛੋਟੀ ਕੁੜੀ ਜਿਸ ਦੇ ਕੱਪੜੇ ਕੱਪੜੇ ਬਹੁਤ ਹੀ ਘੱਟ ਸਨ ਅਚਾਨਕ ਇੱਕਦਮ ਬਹੁਤ ਜ਼ੋ ਜ਼ੋਰ ਜ਼ੋਰਦੀ ਮੀਹ ਮੀਂਹ ਆਇਆ ਜਿਸ ਕਾਰਨ ਮੀਂਹ ਲੱਗਣ ਦੀ ਵਜ੍ਹਾ ਸਾਰੇ ਲੋਕ ਉਸ ਕੁੜੀ ਨੂੰ ਬੋਲਣ ਲੱਗੇ ਕਿ ਤੂੰ ਬਦਕਿਸਮਤ ਹਾਂ ਕਿਸਮਤ ਹੈ ਤੇਰੇ ਕਰਕੇ ਇੰਨਾਂ ਜ਼ਿਆਦਾ ਮੀਂਹ ਪਿਆ ਜਿਸ ਕਰਕੇ ਇਸ ਕਹਾਣੀ ਇਸ ਤੋਂ ਇਹ ਸਿੱਖਿਆ ਮਿਲਦੀ ਹੈ ਇਸ ਦਾ ਸਿਰਲੇਖ ਮੇਨ ਇਹ ਹੈ ਕਿ ਕਿਸਮਤ